ਸਿਹਤ ਸੰਭਾਲ ਦੇ ਨਾਲੋਂ ਵੀ ਹੋਰਨਾਂ ਬਹੁਤ ਖੇਤਰਾਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਵਧਿਆ ਹੋਇਆ ਵੀ ਅੱਜ ਕੱਲ੍ਹ ਮਹਿੰਗਾਈ ਦੇ ਕਾਰਨ ਸਾਰੇ ਖੇਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਵਧਿਆ ਹੋਇਆ ਪਰ ਜਿੱਥੋਂ ਤੱਕ ਆਪਾਂ ਸਿਹਤ ਸੰਭਾਲ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਜਿਵੇਂ ਕਿ ਮੰਨ ਲਓ ਦੋ ਹਜ਼ਾਰ ਵੀਹ ਦੇ ਵਿੱਚ ਆਪਾਂ ਨੂੰ ਕਰੋਨਾ ਕਾਲ ਆਇਆ ਸੀ ਵੀ ਕਰੋਨਾ ਕਾਲ ਚੱਲਿਆ ਦੁਨੀਆ 'ਤੇ ਉਹਦੇ ਵਿੱਚ ਵੀ ਸਿਹਤ ਸੰਭਾਲ ਦੇ ਵਿੱਚ ਐਨਾ ਸਾਰਾ ਭ੍ਰਿਸ਼ਟਾਚਾਰ ਵਧਿਆ ਕਿ ਵੀ ਜਿਨ੍ਹਾਂ ਨੂੰ ਕਰੋਨਾ ਹੋ ਗਿਆ ਉਹਨਾਂ ਦੇ ਫੇਫੜੇ ਕੰਮ ਕਰਨਾ ਬੰਦ ਕਰ ਜਾਂਦੇ ਸੀ ਉਹ ਡਾਇਮਜ ਹੋ ਜਾਂਦੇ ਸੀ ਜਿਹਦੇ ਵਿੱਚ ਵੀ ਜਿਹੜੇ ਚੰਗੇ ਘਰਾਣਿਆਂ ਦੇ ਲੋਕ ਸੀ ਜਿਹੜੇ ਅਮੀਰ ਲੋਕ ਸੀ ਉਹ ਤਾਂ ਆਪਦੇ ਜਿਵੇਂ ਕਿ ਉਹਨਾਂ ਦਾ ਕੋਈ ਬੱਚਾ ਬਿਮਾਰ ਹੁੰਦਾ ਸੀ ਉਹਨਾਂ ਨੂੰ ਔਕਸੀਜਨ ਸਿਲੰਡਰ ਸਾਰਾ ਕੁਝ ਮੁੱਲ ਦਿੰਦੇ ਸੀ ਅਤੇ ਉਹਨਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਇੱਕ ਲੱਛਣ ਆ ਅਤੇ ਜਿਹੜੇ ਗਰੀਬ ਹੁੰਦੇ ਸੀ ਉਹਨਾਂ ਨੂੰ ਬੈਡ ਵੀ ਨਹੀਂ ਮਿਲਦਾ ਸੀ ਵੈਂਟੀਲੇਟਰ ਬੈਡ ਸਾਰੇ ਕੁਛ ਬੁੱਕ ਹੋ ਗਏ ਸੀ ਅਤੇ ਉਹ ਭ੍ਰਿਸ਼ਟਾਚਾਰ ਦੇ ਵਿੱਚ ਇਹ ਐਵੇਂ ਆਉਂਦੇ ਆ ਕਿ ਜਿਹੜੇ ਬੈਡ ਸੀ ਵੈਂਟੀਲੇਟਰ ਸੀ ਉਹ ਉਨ੍ਹਾਂ ਹੀ ਘਰਾਣਿਆਂ ਨੂੰ ਦਿੱਤੇ ਜਾਂਦੇ ਸੀ ਜਿਹੜੇ ਕੋਈ ਚੰਗੇ ਡੋਕਟਰਾਂ ਨੂੰ ਹੋਰ ਜਿਹੜੇ ਉੱਥੇ ਕੋਈ ਕੰਪੋਡਰ ਲੱਗੇ ਨੇ ਮੈਡੀਕਲ ਵਾਲੇ ਹੋਰ ਨਰਸਾਂ ਵਗੈਰਾ ਲੱਗੀਆਂ ਨੇ ਉਹਨਾਂ ਨੂੰ ਕੋਈ ਚੰਗਾ ਪੈਸਾ ਦੇ ਦਿੰਦੇ ਸੀ ਅਤੇ ਭ੍ਰਿਸ਼ਟਾਚਾਰ ਦੇ ਦੂਜੇ ਚੱਕਰ ਦੇ ਵਿੱਚ ਜਿਵੇਂ ਕਿ ਕੋਈ ਸਿਹਤ ਸਹੂਲਤਾਂ ਦੇ ਵਿੱਚ ਸਰਕਾਰੀ ਡੋਕਟਰ ਹੁੰਦਾ ਉਹ ਸਰਕਾਰੀ ਡੋਕਟਰ ਆਪ ਸਰਕਾਰੀ ਤਨਖਾਹ ਤਾਂ ਲੈ ਹੀ ਰਿਹਾ ਅਤੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਓਨਾ ਹਾਜ਼ਰ ਨਹੀਂ ਹੁੰਦਾ ਜਿਵੇਂ ਕਿ ਉਹਨੇ ਮੰਨ ਲਓ ਆਪਦੀ ਦੋ ਘੰਟੇ ਡਿਊਟੀ ਕਰਨੀ ਹੈ ਉਹ ਆਪਦੀ ਇੱਕ ਘੰਟਾ ਹੀ ਡਿਊਟੀ ਕਰਕੇ ਜਾਂਦੇ ਇਹ ਵੀ ਬਹੁਤ ਭ੍ਰਿਸ਼ਟਾਚਾਰ ਹੁੰਦਾ ਅੰਦਰ ਦੀ ਅੰਦਰ ਅਤੇ ਕਈ ਵਾਰ ਜਿਹੜੀਆਂ ਸਿਹਤ ਸਹੂਲਤਾਂ ਇਹਦੇ ਵਿੱਚ ਕਰੋਨਾ ਕਾਲ ਦੇ ਵਿੱਚ ਵੀ ਬਹੁਤ ਕੁਛ ਆਇਆ ਇਸ ਤੋਂ ਇਲਾਵਾ ਜਿੰਨੇ ਵੀ ਸਾਰੇ ਜਿਹੜੇ ਡੋਕਟਰ ਹੁੰਦੇ ਆ ਉਹ ਅਲੱਗ ਉਹਨਾਂ ਦਾ ਆਪਦਾ ਡੋਕਟਰ ਦਾ ਸਰਕਾਰੀ ਹਸਪਤਾਲ ਦੇ ਵਿੱਚ ਡਿਊਟੀ ਨਿਭਾਉਣ ਦੇ ਨਾਲ ਨਾਲ ਉਹ ਆਪਦਾ ਸਰ ਪ੍ਰਾਈਵੇਟ ਬਹੁਤ ਸਾਰੇ ਸਰਕਾਰੀ ਹੌਸਪੀਟਲ ਖੋਲ੍ਹ ਲੈਂਦੇ ਆ ਜਿਹਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਲਿੰਗ ਜਾਂਚ ਕਾਨੂੰਨੀ ਪਾਪ ਹੈ ਉਹ ਬੋਰਡ ਲਿਖ ਲਿਖ ਕੇ ਲਾ ਲੈਂਦੇ ਆ ਪਰ ਉਹਨਾਂ ਦੇ ਪ੍ਰਾਈਵੇਟ ਹੌਸਪੀਟਲਾਂ ਦੇ ਵਿੱਚ ਲਿੰਗ ਜਾਂਚ ਹੁੰਦੀ ਆ ਕਿ ਮੁੰਡੇ ਕੁੜੀ ਦਾ ਟੈਸਟ ਕਿਵੇਂ ਕਰਵਾਇਆ ਜਾਂਦਾ ਸਾਡੇ ਵੀ ਇਹਦੇ ਪੇਟ ਵਿੱਚ ਮੁੰਡਾ ਜਾਂ ਇਹਦੇ ਪੇਟ ਵਿੱਚ ਕੁੜੀ ਆ ਇਹ ਵੀ ਡਾਕਟਰ ਰਿਸ਼ਵਤਾਂ ਲੈ ਲੈ ਕੇ ਪੰਦਰ੍ਹਾਂ ਪੰਦਰ੍ਹਾਂ ਵੀਹ ਵੀਹ ਹਜ਼ਾਰ ਲੈ ਲੈ ਕੇ ਲਿੰਗ ਦਾ ਟੈਸਟ ਕਰਦੇ ਆ ਅਤੇ ਇਹਦੇ ਵਿੱਚ ਹੀ ਜਿਹੜੇ ਡੋਕਟਰ ਹੁੰਦੇ ਆ ਉਹਨਾਂ ਦੇ ਆਪ ਹੀ ਪ੍ਰਾਈਵੇਟ ਬਾਹਰ ਮੈਡੀਕਲ ਹੁੰਦੇ ਜਾਂ ਉਹਨਾਂ ਨਾਲ ਕੋਈ ਕੰਟੈਕਟ ਹੁੰਦਾ ਉਹ ਓਈ ਉਹੀ ਦਵਾਈਆਂ ਲਿਖਦੇ ਨੇ ਜ਼ਿਆਦਾਤਰ ਸਰਕਾਰੀ ਹੌਸਪੀਟਲ ਵਾਲੇ ਡਾਕਟਰ ਜ਼ਿਆਦਾਤਰ ਉਹੀ ਦਵਾਈਆਂ ਲਿਖਦੇ ਨੇ ਜਿਹੜੀਆਂ ਕਿ ਬਾਹਰ ਉਹਨਾਂ ਦੇ ਮੈਡੀਕਲ 'ਤੇ ਉਪਲਬਧ ਹੁੰਦੀਆਂ ਵੀ ਇਹ ਗੱਲ ਦਾ ਇੱਕ ਵਾਰ ਮੈਨੂੰ ਬਹੁਤ ਵੱਡਾ ਛੋਕ ਲੱਗਿਆ ਕਿ ਉਹ ਉਹ ਦਵਾਈ ਉਹਨਾਂ ਜਿਹੜੀ ਡਾਕਟਰ ਦਵਾਈ ਲਿਖ ਦਿੰਦਾ ਸਰਕਾਰੀ ਹੌਸਪੀਟਲ ਵਾਲਾ ਉਹ ਹੋਰ ਆਪਾਂ ਨੂੰ ਕਿਸੇ ਵੀ ਪ੍ਰਾਈਵੇਟ ਜਿਹੜੀਆਂ ਫੋਰਮੈਸੀਆਂ ਹੁੰਦੀਆਂ ਉਹਨਾਂ ਤੋਂ ਨਹੀਂ ਮਿਲਦੀ ਹਾਲਾਂਕਿ ਉਹਨਾਂ ਦੇ ਪ੍ਰਾਈਵੇਟ ਮੈਡੀਕਲ ਤੋਂ ਉਹ ਦਵਾਈ ਮਿਲੇਗੀ ਹੋਰ ਆਪਾਂ ਨੂੰ ਕਿਤੋਂ ਵੀ ਨਹੀਂ ਮਿਲਦੀ ਉਹ ਦਵਾਈ